ਹੈਲੋ ਸਤਿ ਸ਼੍ਰੀ ਅਕਾਲ ਵੀਰੇ ਐਮਾਜ਼ੋਨ ਕਸਟਮਰ ਕੇਅਰ ਤੋਂ ਬੋਲਦੇ ਹੋ ਮੈਂ ਥੋੜ੍ਹੇ ਕੁ ਦਿਨ ਪਹਿਲਾਂ ਹੀ ਤੁਹਾਡੇ ਤੋਂ ਇੱਕ ਸਕੈਚ ਕਲਰ ਔਡਰ ਕੀਤੇ ਸੀਗੇ ਕਿਉਂਕਿ ਮੈਨੂੰ ਪੇਂਟਿੰਗ ਕਰਨਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਉਹ ਮੈਨੂੰ ਸਕੈਚ ਕਰ ਬਹੁਤ ਹੀ ਜ਼ਿਆਦਾ ਪਰਸਨਲੀ ਪਸੰਦ ਆਏ ਅਤੇ ਮੈਂ ਥੋੜ੍ਹੇ ਉਹ ਮੈਨੂੰ ਸਕੈਚਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇਸ ਲਈ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਮਾਰਕੀਟ ਵਿੱਚ ਗਏ ਸੀ ਅਤੇ ਉੱਥੇ ਜਦੋਂ ਉੱਥੇ ਜਾ ਕੇ ਮੈਂ ਜਦੋਂ ਦੁਕਾਨ 'ਤੇ ਪ੍ਰਾਈਜ਼ ਪੁੱਛਿਆ ਤਾਂ ਉਹਨਾਂ ਦਾ ਪ੍ਰਾਈਜ਼ ਬਹੁਤ ਜ਼ਿਆਦਾ ਸੀਗਾ ਤਾਂ ਮੇਰੇ ਫਰੈਂਡ ਵੀ ਮੇਰੇ ਨਾਲ ਇੱਕ ਗਏ ਹੋਏ ਸੀ ਅਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਹੈ ਕਿ ਮੈਂ ਐਮਾਜ਼ਾਨ ਤੋਂ ਇਹ ਕਲਰ ਖ਼ਰੀਦ ਸਕਦੀ ਹਾਂ ਜਦੋਂ ਮੈਂ ਐਮਾਜ਼ੋਨ 'ਤੇ ਇਸ ਦੇ ਪ੍ਰਾਈਜ ਕੀਤ ਚੈੱਕ ਕੀਤਾ ਤਾਂ ਮੈਨੂੰ ਇਹ ਬਹੁਤ ਹੀ ਘੱਟ ਰੇਟ 'ਤੇ ਅਤੇ ਸੱਤਰ ਪ੍ਰਸੈਂਟ ਡਿਸਕਾਊਂਟ 'ਤੇ ਮਿਲ ਗਏ ਹਨ ਜੋ ਕਿ ਮੈਨੂੰ ਪਰਸਨਲੀ ਬਹੁਤ ਵਧੀਆ ਲੱਗੇ ਜਦੋਂ ਮੈਂ ਇਹਨਾਂ ਨੂੰ ਯੂਜ ਕਰਕੇ ਦੇਖਿਆ ਤਾਂ ਇਹ ਬਹੁਤ ਹੀ ਵਧੀਆ ਪੇਂਟਿੰਗ ਕਰਦੇ ਸੀਗੇ ਅਤੇ ਇਸ ਜਿਹਨਾਂ ਕਰਕੇ ਮੈਨੂੰ ਰੋਜ਼ ਰੋਜ਼ ਅਤੇ ਜ਼ਿਆਦਾਤਰ ਪੇਂਟਿੰਗ ਕਰਨ ਦਾ ਮਨ ਕਰਦਾ ਅਤੇ ਇਹ ਸਕੈਚ ਬਹੁਤ ਵਧੀਆ ਅਤੇ ਜੇਕਰ ਮੈਨੂੰ ਇਹ ਹੋਰ ਵੀ ਵਧੀਆ ਲੱਗੇ ਤਾਂ ਮੈਂ ਤੁਹਾਡੇ ਐਮਾਜ਼ੋਨ ਤੋਂ ਹੋਰ ਵੀ ਕੁਛ ਜ਼ਿਆਦਾ ਟਰਾਈ ਕਰ ਸਕਦੀ ਹਾਂ